ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੂੰ ਮੰਨਿਆ ਜਾਂਦਾ ਹੈ ਦਰਬਾਰ ਸਾਹਿਬ ਵਿੱਚ ਦੂਰੋਂ ਦੂਰੋਂ ਸਾਧ ਸੰਗਤਾਂ ਮੱਥਾ ਟੇਕਣ ਲਈ ਅਤੇ ਆਪਣੀਆਂ ਮਨੋਕਾਮਨਾਵਾਂ ਨੂੰ ਪਾਉਣ ਲਈ ਇੱਥੇ ਮੱਥਾ ਟੇਕਦੇ ਹਨ ਅਤੇ ਆਪਣਾ ਇਸ ਦੇ ਨਾਲ ਹੀ ਸਭ ਤੋਂ ਮਹੱਤਵਪੂਰਨ ਸੈਰ ਸਪਾਟੇ ਦੀਆਂ ਜਗ੍ਹਾ ਦੇਖਣ ਨੂੰ ਜਿਵੇਂ ਵਾਹਗਾ ਬਾਰਡਰ ਵਾਹਗਾ ਬਾਰਡਰ 'ਤੇ ਸਲਾਮੀ ਪਰੇਡਾਂ ਹੁੰਦੀਆਂ ਹਨ ਅਤੇ ਕਾਫੀ ਦਰਸ਼ਕ ਆਪਣਾ ਦੇਖਣ ਯੋਗ ਇੰਜੋਏ ਕਰਦੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਫਿਰੋਜ਼ਪੁਰ ਉੱਤੇ ਹੁਸੈਨੀਵਾਲਾ ਬਾਰਡਰ ਵੀ ਕਾਫੀ ਦਿਲਚਸਪ ਜਗ੍ਹਾ ਹੈ ਇੱਥੇ ਵੀ ਸ਼ਾਮ ਦੇ ਟਾਈਮ ਭਾਰਤ ਪਾਕਿਸਤਾਨ ਦੀ ਫੌਜ ਸਲਾਮੀ ਅਤੇ ਪਰੇਡ ਕਰਦੀ ਹੈ ਇਸ ਤੋਂ ਇਲਾਵਾ ਆਪਣੇ ਬਠਿੰਡਾ ਦੇ ਵਿੱਚ ਕਿਲ੍ਹਾ ਸਾਹਿਬ ਗੁਰਦੁਆਰਾ ਸਾਹਿਬ ਦੇਖਣ ਯੋਗ ਕਾਫੀ ਮਹੱਤਵਪੂਰਨ ਜਗ੍ਹਾ ਹੈ ਅਤੇ ਤਲਵੰਡੀ ਸਾਬੋ ਦਮਦਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ ਇਤਿਹਾਸਕ ਸਥਾਨ ਮੰਨਿਆ ਗਿਆ ਹੈ ਇਸ ਤੋਂ ਇਲਾਵਾ ਬਠਿੰਡਾ ਦੇ ਜ਼ਿਲ੍ਹਾ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਲਹਿਰਾ ਬੇਗੇ ਦੇ ਨੇੜੇ ਇੱਕ ਕਾਫੀ ਮਨੋਰੰਜਨ ਦਾ ਸਾਧਨ ਵਾਟਰ ਪਾਰਕ ਨਵਾਂ ਖੁਲ੍ਹਿਆ ਹੈ ਜਿੱਥੇ ਗਰਮੀ ਦੇ ਟਾਈਮ ਵਿੱਚ ਬੱਚੇ ਸਵਿਮਿੰਗ ਪੂਲ ਖ ਵਿੱਚ ਨਹਾਉਣ ਲਈ ਕਾਫੀ ਇੰਜੋਏ ਕਰਨ ਲਈ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਹੋਰ ਕਾਫੀ ਪੰਜਾਬ ਦੇ ਵਿੱਚ ਦੇਖਣ ਯੋਗ ਜਗ੍ਹਾ ਹਨ ਜਿੱਥੇ ਇੰਜੋਏ ਕਰਨ ਦੇ ਨਾਲ ਨਾਲ ਮਨ ਨੂੰ ਖੁਸ਼ੀ ਵੀ ਮਿਲਦੀ ਹੈ ਅਤੇ ਬੰਦਾ ਤੰਦਰੁਸਤ ਵੀ ਰਹਿੰਦਾ ਹੈ